ਹਾਂ ਮੇਰੇ ਕੋਲ ਇੱਕ ਮਨਪਸੰਦ ਕਿਤਾਬ ਹੈ ਉਸ ਵਿੱਚ ਸੱਚੀਆਂ ਘਟਨਾਵਾਂ ਲਿਖੀਆ ਹੋਈਆਂ ਹੈ ਉਹਨਾਂ ਵਿੱਚ ਗੁਰੂ ਜੀ ਬਾਰੇ ਲਿਖਿਆ ਹੋਇਆ ਹੈ ਕਿਵੇਂ ਉਨ੍ਹਾਂ ਨੇ ਆਪਣਾ ਸਾਦਾ ਜੀਵਨ ਬਤੀਤ ਕੀਤਾ ਅਤੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਉਹ ਮੈਨੂੰ ਇਸ ਕਰਕੇ ਦਿਲਚਸਪ ਲੱਗਦੀ ਹੈ ਕਿਉਂਕਿ ਉਸ ਵਿੱਚ ਸੱਚੀਆਂ ਘਟਨਾਵਾਂ ਲਿਖੀਆਂ ਹੋਈਆਂ ਹਨ